ਹੈਲੋ ਹਾਂਜੀ ਵੀਰੇ ਤੁਸੀਂ ਸਵੀਗ਼ੀ ਤੋਂ ਬੋਲਦੇ ਹੋ ਹਾਂਜੀ ਜੀ ਮੇਰਾ ਆਰਡਰ ਲਿਖਿਓ ਸਬਜ਼ੀ ਦਾਲ ਰੋਟੀ ਜੋ ਮਰਜ਼ੀ ਜੋ ਕੁਛ ਮਿਲ ਗਿਆ ਨਾ ਤੁਸੀਂ ਬਸ ਲੈ ਕੇ ਆ ਜਾਓ ਜੋ ਵੀ ਹੁਣ ਉਹ ਤੁਸੀਂ ਦੇਖੋ ਕਿ ਤੁਸੀਂ ਕਿੱਥੋਂ ਲੈ ਕੇ ਆਉਣਾ ਮੈਂ ਰਹਿੰਦਾ ਹਾਂ ਭਾਅ ਜੀ ਮੋਡਲ ਟਾਊਨ ਹਾਊਸ ਨੰਬਰ ਚਾਰ ਸੌ ਪੰਜਾਹ ਠੀਕ ਆ ਮੇਰੇ ਕੋਲ ਚਾਰ ਪੰਜ ਬੰਦੇ ਹੈਗੇ ਆ ਚਾਰ ਪੰਜ ਬੰਦਿਆਂ ਦਾ ਖਾਣਾ ਚਾਹੀਦਾ ਸਾਨੂੰ ਜਿੱਥੋਂ ਮਰਜ਼ੀ ਤੁਸੀਂ ਲੈ ਕੇ ਆਓ ਤੁਸੀਂ ਬਸ ਉਹ ਹੀ ਦੇਖਿਓ ਕਿ ਟਾਈਮ ਦੀ ਬਹੁਤ ਘਾਟ ਆ ਸਾਡੇ ਕੋਲ ਸਾਡੇ ਕੋਲ ਟਾਈਮ ਨਹੀਂ ਹੈਗਾ ਅਤੇ ਪਲੀਜ਼ ਜਿੰਨਾ ਜਲਦੀ ਹੋ ਸਕੇ ਨਾ ਜਲਦੀ ਤੋਂ ਜਲਦੀ ਆਰਡਰ ਕਰਵਾ ਦਿਓ ਠੀਕ ਆ ਅਤੇ ਮੈਨੂੰ ਦਸ ਮਿੰਟ ਦੇ ਅੰਦਰ ਦਸ ਜਾਂ ਪੰਦਰਾ ਹੱਦ ਤੋਂ ਹੱਦ ਪੰਦਰਾ ਮਿੰਟ ਦੇ ਅੰਦਰ ਜੋ ਮਰਜ਼ੀ ਡਲੀਵਰੀ ਮਿਲ ਜਾਵੇ ਜੋ ਕੁਝ ਵੀ ਹੋਵੇ ਸਬਜ਼ੀ ਦਾਲ ਰੋਟੀ ਅਤੇ ਜਿੱਥੋਂ ਮਰਜ਼ੀ ਤੁਸੀਂ ਉਹ ਐਕਸਫਲੋਰ ਕਰੋ ਮੈਨੂੰ ਨਹੀਂ ਪਤਾ ਬਸ ਮੈਨੂੰ ਤਾਂ ਹੁਣ ਸਮੇਂ ਨਹੀਂ ਹੈਗਾ ਮੇਰੇ ਕੋਲ ਸਮਾਂ ਨਹੀਂ ਹੈਗਾ ਇਹ ਬਸ ਮਾਡਲ ਟਾਊਨ ਦੇ ਵਿੱਚ ਅਤੇ ਹਾਊਸ ਨੰਬਰ ਚਾਰ ਸੌ ਪੰਜਾਹ ਦੇ ਵਿੱਚ ਪਹੁੰਚਾ ਦਿਓ ਠੀਕ ਆ ਧੰਨਵਾਦ ਵੀਰੇ